ਸਤਿ ਸ੍ਰੀ ਅਕਾਲ ਸਰ ਮੇਰਾ ਨਾਮ ਸੁਧਾਂਸ਼ੂ ਸ਼ਰਮਾ ਮੈਂ ਅੱਜ ਤੋਂ ਦਸ ਪੰਦਰਾਂ ਦਿਨ ਪਹਿਲਾਂ ਫਲਿੱਪਕਾਰਟ ਤੋਂ ਇੱਕ ਸਕੂਲ ਬੈਗ ਔਡਰ ਕੀਤਾ ਸੀ ਸਕੂਲ ਬੈਗ ਕੰਪਨੀ ਸੀ ਏਬੀਸੀ ਜਦੋਂ ਉਹ ਬੈਗ ਮੇਰੇ ਕੋਲ ਪੁੱਜਿਆ ਤਾਂ ਮੈਂ ਦੇਖਿਆ ਕਿ ਜੋ ਸਕੂਲ ਬੈਗ ਔਫਿਸ਼ੀਅਲ ਸਾਇਟ 'ਤੇ ਦੱਸਿਆ ਗਿਆ ਸੀ ਅਤੇ ਜੋ ਅਸਲ ਵਿੱਚ ਮੇਰੇ ਕੋਲ ਸਮਾਨ ਪੁੱਜਿਆ ਉਹਦੇ ਵਿੱਚ ਬਹੁਤ ਫਰਕ ਸੀ ਜੋ ਮੈਨੂੰ ਦੱਸਿਆ ਗਿਆ ਸੀ ਉਸ ਵਿੱਚ ਉਹਦਾ ਮਟੀਰੀਅਲ ਬਹੁਤ ਵਧੀਆ ਸੀ ਉਸ ਵਿੱਚ ਬਹੁਤ ਜੇਬਾਂ ਅਤੇ ਬਹੁਤ ਚੈਨਾਂ ਸੀ ਪਰ ਜਦੋਂ ਉਹ ਮੇਰੇ ਕੋਲ ਪੁੱਜਿਆ ਤਾਂ ਉਹ ਸਾਈਜ਼ 'ਚ ਬਹੁਤ ਛੋਟਾ ਸੀ ਜਿਸ ਕਰਕੇ ਮੈਨੂੰ ਪਸੰਦ ਨਹੀਂ ਆਇਆ ਉੱਤੋਂ ਜਦੋਂ ਮੈਂ ਉਹਦੇ ਅੰਦਰ ਦੇਖਿਆ ਤਾਂ ਉਹਦਾ ਮਟੀਰੀਅਲ ਉਨਾ ਵਧੀਆ ਨਹੀਂ ਸੀ ਪਰ ਜਦੋਂ ਇਸ ਬਾਰੇ ਮੈਂ ਆਪਣੀ ਕੰਪਲੇਨ ਔਫਿਸ਼ੀਅਲ ਵੈਬਸਾਈਟ 'ਤੇ ਕੀਤੀ ਜੋ ਕਿ ਮੇਰਾ ਕੰਪਲੇਨ ਨੰਬਰ ਇੱਕ ਦੋ ਤਿੰਨ ਚਾਰ ਹੈ ਤਾਂ ਕੁੱਝ ਦਿਨ ਬੀਤਣ ਤੋਂ ਬਾਅਦ ਵੀ ਉਸ 'ਤੇ ਕੋਈ ਸੰਗਿਆਨ ਨਹੀਂ ਲਿਆ ਗਿਆ ਜਿਸ ਗੱਲ ਤੋਂ ਮੈਂ ਬਹੁਤ ਦੁਖੀ ਹਾਂ ਮੈਨੂੰ ਨਹੀਂ ਸੀ ਪਤਾ ਕਿ ਇਹ ਕੰਪਨੀ ਦਾ ਸਮਾਨ ਇਤਨਾ ਇੰਨਾ ਵਧੀਆ ਨਹੀਂ ਸੀ ਜਿੰਨਾ ਮੈਂ ਔਫਿਸ਼ਅਲ ਵੈਬਸਾਈਟ 'ਤੇ ਦੇਖਿਆ ਸੀ ਅਤੇ ਮੈਂ ਹੁਣ ਚਾਹੁੰਦਾ ਹਾਂ ਕਿ ਇਹ ਸਮਾਨ ਤੁਸੀਂ ਵਾਪਸ ਲੈ ਲਵੋ ਕਿਉਂਕਿ ਜੋ ਸਮਾਨ ਦਿਖਾਇਆ ਗਿਆ ਸੀ ਜਿਸ ਰੇਟ 'ਤੇ ਦੱਸਿਆ ਗਿਆ ਸੀ ਇਹ ਸਮਾਨ ਉਸ ਤੋਂ ਬਿਲਕੁਲ ਵੱਖ ਨਿਕਲਿਆ ਹੈ ਇਸ ਸਮਾਨ ਵਿੱਚ ਨਾ ਮਟੀਰੀਅਲ ਵਧੀਆ ਹੈ ਨਾ ਉਨ੍ਹਾਂ ਸਾਈਜ਼ ਹੈ ਜਿਸ ਕਰਕੇ ਇਹ ਮੇਰੇ ਉਪਯੋਗ ਵਿੱਚ ਨਹੀਂ ਆਵੇਗਾ ਅਤੇ ਮੈਂ ਚਾਹੁੰਦਾ ਹਾਂ ਕਿ ਤੁਸੀਂ ਆਪਣੇ ਸਮਾਨ ਦੀ ਕੁਆਲਿਟੀ ਨੂੰ ਥੋੜ੍ਹਾ ਇਮਪਰੂਵ ਕਰੋ ਵਧੀਆ ਕਰੋ ਤਾਂ ਕਿ ਅੱਗੇ ਤੋਂ ਜਿਹੜਾ ਵੀ ਇਹ ਸਮਾਨ ਲਵੇ ਉਹ ਦੁਖੀ ਨਾ ਹੋਵੇ